ਪੰਜਾਬ ਵਿੱਚ ਸਿਹਤ ਸੰਭਾਲ ਨੂੰ ਹੋਰ ਕਫਾਇਤੀ ਅਤੇ ਪਹੁੰਚਣਯੋਗ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਹੋਸਪਿਟਲਸ ਵਿੱਚ ਡਾਕਟਰ ਹੈ ਉਹਨਾਂ ਦਾ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਚੰਗੀ ਤਰ੍ਹਾਂ ਸਾਰੇ ਲੋਕਾਂ ਦਾ ਇਲਾਜ ਵਧੀਆ ਤਰੀਕੇ ਨਾਲ ਕਰਨ ਕਿਉਂਕਿ ਮੋਸਟਲੀ ਜਿਹੜੇ ਹੋਸ ਉਹ ਡਾਕਟਰਸ ਹੈਗੇ ਆ ਹੌਸਪਿਟਲਾਂ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪ੍ਰਾਈਵੇਟ ਕਲੀਨਿਕ ਖੋਲ੍ਹੀਆਂ ਹੋਈਆਂ ਉਹਦੇ ਕਰਕੇ ਉਹ ਚਾਹੁੰਦੇ ਆ ਕਿ ਸਾਰੇ ਦੇ ਸਾਰੇ ਜਿੰਨੇ ਵੀ ਉਹਨਾਂ ਕੋਲ ਮਰੀਜ਼ ਆਉਂਦੇ ਆ ਉਹ ਸਾਰੇ ਦੇ ਸਾਰੇ ਪ੍ਰਾਈਵੇਟ ਹੀ ਜਾਣ ਸਰਕਾਰੀ ਹੋਸਪੀਟਲਾਂ 'ਚ ਤਾਂ ਆਉਣ ਹੀ ਨਾ ਦੂਜੀ ਗੱਲ ਇਹ ਕਿ ਜਿਹੜੀ ਗੋ ਸਰਕਾਰ ਜਿਹੜੀ ਹੈ ਉਹ ਹੈਲਥ ਸਕੀਮਾਂ ਬਣਾਉਂਦੀ ਹੈ ਉਹਨਾਂ ਬਾਰੇ ਅਵੇਅਰ ਹੋਣਾ ਚਾਹੀਦਾ ਉਹਨਾਂ ਦੀ ਵਾਰ ਵਾਰ ਟੀ ਵੀ 'ਤੇ ਮਸ਼ਹੂਰੀ ਆਉਣੀ ਚਾਹੀਦੀ ਹੈ ਜਾਂ ਫਿਰ ਕੋਈ ਇਵੇਂ ਦੀ ਹੋਣਾ ਚਾਹੀਦਾ ਤਾਂ ਕਿ ਉਹਦੀ ਜਿਹੜੀ ਸਕੀਮ ਹੈ ਉਹਦੇ ਬਾਰੇ ਹਰ ਬੰਦਾ ਜਿਹੜਾ ਜਾਣੂ ਹੋ ਸਕੇ ਔਰ ਹਰ ਹਰ ਬੰਦਾ ਜਿਹੜਾ ਗਰੀਬ ਤੋਂ ਗਰੀਬ ਬੰਦਾ ਵੀ ਉਹਦਾ ਫਾਇਦਾ ਜਿਹੜਾ ਉਹ ਲੈ ਸਕੇ ਇੱਕ ਕੋਈ ਐਪ ਇਵੇਂ ਦੀ ਹੋਣੀ ਚਾਹੀਦੀ ਹੈ ਜਿਹਦੇ ਤੋਂ ਕਿ ਆਪਾਂ ਫੋਨ ਕਰਕੇ ਜਾਂ ਕੁਛ ਕਿਸੇ ਵੀ ਤਰੀਕੇ ਨਾਲ ਕੋਈ ਉਹਨਾਂ ਨੂੰ ਕਨਵੇ ਕਰਕੇ ਅਤੇ ਉਹਨਾਂ ਨੂੰ ਦੱਸ ਦੇਣ ਕਿ ਹਾਂ ਪੀ ਤੁਹਾਡੇ ਲਈ ਆਹ ਆਹ ਸਕੀਮ ਜਿਹੜੀਆਂ ਅਵੇਲੇਬਲ ਹੈਗੀਆਂ ਜਿੱਦਾਂ ਦਾ ਤੁਸੀਂ ਆਹ ਬੈਨੀਫਿਟ ਜਿਹੜਾ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਇੱਕ ਇਨਸ਼ੋਰੈਂਸ ਹੈ ਉਹ ਹੋਣੀ ਜ਼ਰੂਰੀ ਹੈ ਹਰ ਇੱਕ ਬੰਦੇ ਦੀ ਉਹ ਛੋਟੇ ਛੋਟੇ ਪੱਧਰ ਤੋਂ ਹੋਣੀ ਚਾਹੀਦੀ ਹੈ ਮਤਲਬ ਦਸ ਰੁਪਏ ਮਹੀਨੇ ਦੇ ਹੋ ਜਾਣ ਵੀਹ ਰੁਪਏ ਮਹੀਨੇ ਦੇ ਹੋ ਜਾਣ ਤਾਂ ਕਿ ਹਰ ਕੋਈ ਅਫੋਰਡ ਕਰ ਲਏ ਅਤੇ ਉਹ ਨਾ ਆਪਣਾ ਜਿਹੜਾ ਇਨਸ਼ੋਰੈਂਸ ਕਰਵਾ ਲੈਣ ਕਿਉਂਕਿ ਜੇਕਰ ਆਪਾਂ ਦੇਖੀ ਜਾਈਏ ਇਨਸ਼ੋਰੈਂਸ ਜਿਹੜੀ ਆ ਉਹ ਵੀ ਅਮੀਰ ਬੰਦਾ ਹੀ ਕਰਵਾ ਪਾਉਂਦਾ ਗਰੀਬ ਬੰਦਾ ਅਤੇ ਇਨਸ਼ੋਰੈਂਸ ਉਹਨਾਂ ਨੂੰ ਪਤਾ ਹੀ ਨਹੀਂ ਕੁਛ ਵੀ ਅਤੇ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਅੱਗੇ ਜਿਹੜੇ ਗਰੀਬ ਬੰਦੇ ਹੁੰਦੇ ਆ ਉਹ ਇਲਾਜ ਕਰਾਉਣ ਤੋਂ ਰਹਿ ਹੀ ਜਾਂਦੇ ਆ ਇਸ ਕਰਕੇ ਇਨਸ਼ੋਰੈਂਸ ਦਾ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਜਿਹੜੇ ਗੌਰਮੈਂਟ ਦੀ ਹੈਲਥ ਸਕੀਮਾਂ ਆ ਉਹਦੇ ਬਾਰੇ ਵੀ ਉਹਨਾਂ ਨੂੰ ਜਿਹੜੀ ਜਾਣਕਾਰੀ ਆ ਹੋਣੀ ਜ਼ਰੂਰੀ ਆ ਓਕੇ ਜੀ